ਸਤਿ ਸ਼੍ਰੀ ਅਕਾਲ ਜੀ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਮੈਨੂੰ ਖਾਣਾ ਬਣਾਉਣ ਦਾ ਬਹੁਤ ਸ਼ੌਕ ਹੈ ਅਤੇ ਮੈਂ ਆਮ ਤੌਰ 'ਤੇ ਖਾਣਾ ਬਣਾਉਣ ਤੋਂ ਪਹਿਲਾਂ ਉਸਦੀ ਤਿਆਰੀ ਕਰ ਲੈਂਦਾ ਜਿਵੇਂ ਕਿ ਖਾਣਾ ਪਕਾਉਣ ਤੋਂ ਪਹਿਲਾਂ ਸਬਜ਼ੀਆਂ ਵੱਢ ਲੈਣੀਆ ਸਬਜ਼ੀਆਂ ਕੱਟ ਕੱਟ ਕੇ ਕੱਟਦੇ ਕੱਟਦੇ ਜਿਵੇਂ ਆਪਾਂ ਕੜਾਹੀ ਧਰ ਲੈਣੀ ਕੜਾਹੀ ਵਿੱਚ ਤੇਲ ਗਰਮ ਕਰਨਾ ਜਦੋਂ ਤੱਕ ਆਪਾਂ ਸਬਜ਼ੀਆਂ ਕੱਟ ਕੇ ਤਿਆਰ ਕਰ ਲੈਣੀਆ ਉੰਨੀ ਦੇਰ ਤੱਕ ਤੇਲ ਗਰਮ ਹੋ ਜਾਣਾ ਫਿਰ ਤੜਕਾ ਲਾ ਲੇ ਲਾ ਕੇ ਸਬਜ਼ੀ ਬਣਾਈ ਦੂਜੀ ਦੂਜਾ ਕਦੀ ਕਦੀ ਆਪਾਂ ਕਿ ਆਪਾਂ ਜਿਵੇਂ ਕੋਈ ਹੋਰ ਡਿਸ਼ ਬਣਾ ਰਿਹਾ ਸਬਜ਼ੀਆਂ ਨੂੰ ਧੋ ਕੇ ਰੱਖ ਕੇ ਲੈਣਾ ਤਾਂ ਕਿ ਜਦੋਂ ਵੀ ਆਪਾਂ ਸਬਜ਼ੀਆਂ ਸਬਜ਼ੀ ਬਣਾਈਏ ਤਾਂ ਸਾਨੂੰ ਉਸ ਨੂੰ ਦੁਬਾਰਾ ਧੋਣਾ ਨਾ ਪਵੇ ਇਸ ਦੌਰਾਨ ਸਾਡਾ ਸਮਾਂ ਵੀ ਬਰਬਾਦ ਨਹੀਂ ਹੁੰਦਾ ਉਹਦਾ ਮ ਮਸਾਲਾ ਪਹਿਲਾ ਤੋਂ ਪੀਸ ਕੇ ਰੱਖ ਲੈਣਾ ਜਿਵੇਂ ਕੋਈ ਵੀ ਮਸਾਲੇਦਾਰ ਚੀਜ਼ ਆਪਾਂ ਹੀ ਜੀ ਬਣਾ ਰਹੇ ਹਾਂ ਉਹਦਾ ਮਸਾਲਾ ਪਹਿਲਾਂ ਤੋਂ ਪੀਸ ਕੇ ਰੱਖ ਲੈਣਾ ਔਰ ਆਪਾਂ ਇਹਦੇ ਵਿੱਚ ਕਹਿ ਸਕਦੇ ਹਾਂ ਕਿ ਜਿਵੇਂ ਕਿ ਅਦਰਕ ਲਸਣ ਛਿੱਲ ਕੇ ਰੱਖ ਲੈਣਾ ਗੰਢੇ ਕੱਟ ਕੇ ਰੱਖ ਲੈਣੇ ਔਰ ਤਾਂ ਕਿ ਖਾਣਾ ਬਣਾਉਣ 'ਤੇ ਟਾਈਮ ਵਿੱਚ ਅਤੇ ਵਿੱਚ ਸਾਡਾ ਇਹਨਾਂ ਚੀਜ਼ਾਂ ਨੂੰ ਕਰਨ 'ਤੇ ਸਮੇਂ ਨਾ ਖ਼ਰਾਬ ਹੋਵੇ ਅਤੇ ਅਸੀਂ ਜਲਦ ਤੋਂ ਜਲਦ ਆਪਣਾ ਖਾਣਾ ਤਿਆਰ ਕਰ ਲਈਏ ਧੰਨਵਾਦ ਜੀ